ਅੱਜ ਦੇ ਸਮੇਂ 'ਚ ਜਿਹੜੇ ਕਬੀਲੇ ਖੇਤਰ ਬਹੁਤ ਘੱਟ ਦੇਖਣ ਨੂੰ ਮਿਲੇ ਨੇ ਔਰ ਮੇ ਨਹੀਂ ਹੈ ਵੀ ਨਹੀਂ ਹੈ ਜੇ ਹੈ ਵੀ ਹੈ ਅਤੇ ਉਹਨਾਂ ਨੂੰ ਇਹ ਮੁਸ਼ਕਿਲਾਂ ਤਾਂ ਬੜਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜਿਹੜਾ ਮੁਕਾਬਲੇ ਸ੍ਰੋਤਾਂ ਸਿੱਖਿਆ ਸਿੱਖਿਆ ਸਿਹਤ ਦੀ ਗੱਲ ਕਰੀਏ ਤਾਂ ਸਿੱਖਿਆ ਤਾਂ ਉਹ ਇੰਨੇ ਡਿਵੈਲਪ ਨਹੀਂ ਹੋਏ ਹੁੰਦੇ ਕਿ ਉਹ ਸਿੱਖਿਆ ਦੇ ਖੇਤਰ 'ਚ ਜਾ ਸਕਨ ਔਰ ਸਿਹਤ ਸਿਹਤ ਪੱਖੋਂ ਉਹ ਕੀ ਗਏ ਹੈ ਉਹ ਆਪਣੀ ਜੜ੍ਹੀ ਬੂਟੀਆਂ ਦੇ ਆਧਾਰ 'ਤੇ ਹੀ ਆਪਣੇ ਜਿਹੜਾ ਹੈ ਸਾਫ ਸੰਭਾਲ ਕਰ ਲੈਂਦੇ ਨੇ ਆਪਣੇ ਸਿਹਤ ਦਾ ਧਿਆਨ ਰੱਖ ਲੈਂਦੇ ਨੇ ਬੁਨਿਆਦੀ ਲੋੜਾਂ ਬੁਨਿਆਦੀ ਲੋੜਾਂ ਦੇ ਵਿੱਚ ਜਿਹੜਾ ਹੈਗਾ ਉਹ ਇਨਾ ਇਨਾ ਸੋਚਦੇ ਹੀ ਨੀ ਹੈ ਉਹ ਜਿਵੇਂ ਵੀ ਜੋ ਵੀ ਉਹਨਾਂ ਨੂੰ ਮਿਲਦਾ ਜਿਸ ਤਰ੍ਹਾਂ ਕਿ ਪੱਤਿਆਂ ਨਾਲ ਆਪਣਾ ਸਰੀਰ ਨੂੰ ਢੱਕਣਾ ਜਾਂ ਕੁਝ ਉਹਦੇ ਨਾਲ ਹੀ ਆਪਣਾ ਸਹੀ ਆਪਣਾ ਰੋਜ਼ ਕਰ ਕਰਦੇ ਆ ਆਪਣਾ ਮਤਲਬ ਅੱਗੇ ਚਲਾ ਲੈਂਦੇ ਹਨ ਉਹਨਾਂ ਦੇ ਅੱਗੇ ਚੁਨੌਤੀਆਂ ਇਹੀ ਹੈ ਸਾਰੀਆਂ ਚੁਨੌਤੀਆਂ ਇਹੀ ਹੈ ਕਿ ਉਹ ਆਪਣਾ ਆਪਣੇ ਆਪ ਨੂੰ ਇੰਨਾ ਡਿਵੈਲਪ ਨਹੀਂ ਕੀਤਾ ਹੁੰਦਾ ਕਿ ਉਹ ਹੋਰ ਚੀਜ਼ਾਂ ਨੂੰ ਸੋਚ ਸਕਣ ਜਿਵੇਂ ਪੜ੍ਹਾਈ ਹੋਗੀ ਹੈ ਸਿਹਤ ਹੋਗੀ ਹੈ ਬੁਨਿਆਦੀ ਲੋੜਾਂ ਹੋ ਗਈਆਂ ਉਹ ਇੰਨਾ ਉਸ ਵੱਲ ਵੱਧਦੇ ਹੀ ਨੀ ਹੈ ਇਸ ਕਰਕੇ ਇਹ ਚੁਨੌਤੀਆਂ ਉਹਨਾਂ ਦੇ ਸਾਹਮਣੇ ਹਮੇਸ਼ਾ ਪੈਦਾ ਹੁੰਦੀਆਂ ਹੀ ਰਹੀਆਂ